ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਤੁਹਾਡੀ ਔਨਲਾਈਨ ਸ਼ੋਪਿੰਗ ਸੈਂਟਰ ਤੋਂ ਕੁੜਤੀ ਦੀ ਐਡ ਦੇਖ ਕੇ ਮੈਂ ਤੁਹਾਡੇ ਤੋਂ ਕੁੜਤੀਆਂ ਦਾ ਸੈਟ ਮੰਗਵਾਇਆ ਸੀ ਚਾਰ ਕੁੜਤੀਆਂ ਦਾ ਸੈਟ ਸੀਗਾ ਚਾਰ ਕੁੜਤੀਆਂ ਦੇ ਸੈਟ ਵਿੱਚੋਂ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇਹ ਕਹਿਣਾ ਚਾਹਵਾਂਗੀ ਜਿਹੜੀ ਤੁਹਾਡੀ ਡਿਲੀਵਰੀ ਦਾ ਟਾਈਮ ਹੈ ਉਹ ਵੀ ਹਫਤੇ ਦਾ ਕਹਿ ਕੇ ਅਤੇ ਮਹੀਨੇ ਤੋਂ ਬਾਅਦ ਜਿਹੜੀਆਂ ਕੁੜਤੀਆਂ ਨੇ ਉਹ ਮੈਨੂੰ ਰਿਸੀਵ ਹੋਈਆਂ ਨੇ ਦੂਜੀ ਗੱਲ ਜਿਹੜੀਆਂ ਕੁੜਤੀਆਂ ਨੇ ਉਹ ਚਾਰ ਦਾ ਸੈਟ ਸੀ ਪਰ ਮੈਨੂੰ ਦੋ ਹੀ ਪ੍ਰਾਪਤ ਹੋਈਆਂ ਨੇ ਹੁਣ ਤੀਸਰੀ ਗੱਲ ਸੁਣੋ ਜਿਹੜੀ ਤੁਹਾਡੀ ਹੈਗੀ ਉਹ ਜਿਹੜੀ ਕੁੜਤੀਆਂ ਦੇ ਸਾਈਜ਼ ਨੇ ਤੁਹਾਡੇ ਉਹ ਬਹੁਤ ਛੋਟੇ ਨੇ ਅਤੇ ਜਿਹੜੀ ਫਿਟਿੰਗ ਹੈ ਉਹ ਐਨੀ ਕੁ ਬੇਕਾਰ ਹੈ ਵੀ ਉਸ ਨੂੰ ਦੱਸਣ ਦੇ ਲਈ ਮੇਰੇ ਕੋਲ ਸ਼ਬਦ ਹੀ ਨਹੀਂ ਅਤੇ ਮੈਂ ਜਿਹੜੀਆਂ ਤੁਸੀਂ ਕੁੜਤੀਆਂ ਭੇਜੀਆਂ ਨੇ ਇਹ ਮੈਂ ਵਾਪਸ ਭੇਜਣਾ ਚਾਹੁੰਦੀ ਹਾਂ ਪਰ ਮੈਂ ਇੱਕ ਹੋਰ ਦੇਖੀ ਹੈ ਤੁਹਾਡੀ ਜਿਹੜੀ ਜਿਸ ਵੈੱਬਸਾਈਟ ਤੋਂ ਤੁਸੀਂ ਇਹ ਕੁੜਤੀਆਂ ਦੀ ਐਡਵਰਟਾਈਜ਼ ਕੀਤੀ ਸੀ ਉਹ ਵੈਬਸਾਈਟ ਤੁਸੀਂ ਹੁਣ ਬੰਦ ਹੀ ਕਰ ਦਿੱਤੀ ਹੈ ਅਤੇ ਕੋਈ ਹੋਰ ਵੈਬਸਾਈਟ ਹੈ ਉਹ ਸ਼ੁਰੂ ਕਰਤੀ ਕਿਰਪਾ ਕਰਕੇ ਮੈਨੂੰ ਹੁਣ ਦੱਸਿਆ ਜਾਵੇ ਕਿ ਨਵੀਂ ਵੈਬਸਾਈਟ 'ਤੇ ਵੀ ਮੈਂ ਜਾ ਕੇ ਜਿਹੜੀਆਂ ਕੁੜਤੀਆਂ ਨੇ ਉਹ ਵਾਪਸ ਕਰ ਸਕਦੀ ਹਾਂ ਅਤੇ ਜੇ ਕਰ ਸਕਦੀ ਹਾਂ ਤਾਂ ਉਹ ਮੇਰੀਆਂ ਜਿਹੜੀਆਂ ਖਰੀਦੀਆਂ ਹੋਈਆਂ ਕੁੜਤੀਆਂ ਨੇ ਉਹ ਵਾਪਸ ਲਉ ਸਿਸਟਮ ਮੈਨੂੰ ਦੱਸੋ ਅਤੇ ਮੇਰਾ ਰਿਫੰਡ ਹੈ ਉਹ ਵਾਪਸ ਭੇਜਿਆ ਜਾਵੇ